ਮੇਰੇ ਫ਼ੋਨ ਦੇ ਵਿੱਚ ਫੂਡ ਦੀ ਐਪ ਜ਼ੋਮੈਟੋ ਹੈ ਫਿੱਟਨੈੱਸ ਐਪ ਹੈ ਤਾਂ ਕੱਪੜੇ ਖਰੀਦਣ ਲਈ ਮਿਸ਼ੋ ਵਗੈਰਾ ਇਸ ਤਰ੍ਹਾਂ ਦੀਆਂ ਐਪਸ ਨੇ ਜਿਨ੍ਹਾਂ ਨਾਲ ਮੇਰੀ ਜ਼ਿੰਦਗੀ ਸੁਖਾਲੀ ਹੋ ਗਈ ਹੈ ਕਿਉਂਕਿ ਮੈਂ ਘਰ ਬੈਠੇ ਹੀ ਆਪਣੇ ਉਹ ਕੰਮ ਜਿਨ੍ਹਾਂ ਨੂੰ ਮੈਨੂੰ ਬਾਹਰ ਜਾ ਕੇ ਕਰਨਾ ਹੈ ਉਨ੍ਹਾਂ ਨੂੰ ਘਰ ਕਰ ਸਕਦੀ ਹਾਂ